ਹੈਲੋ ਸਰ ਮੈਂ ਜਪਨੀਤ ਕੌਰ ਗੱਲ ਕਰ ਰਹੀ ਹਾਂ ਕੀ ਤੁਸੀਂ ਮਿੰਤਰਾ ਕਸਟਮਰ ਕੇਅਰ ਤੋਂ ਗੱਲ ਕਰ ਰਹੇ ਹੋ ਸਰ ਮੈਂ ਤੁਹਾਡੀ ਐਪ ਤੋਂ ਦੋ ਜੀਨਸ ਔਡਰ ਕੀਤੀਆਂ ਸੀ ਇੱਕ ਬਲੂ ਕਲਰ ਦੀ ਸੀ ਅਤੇ ਇੱਕ ਬਲੈਕ ਕਲਰ ਦੀ ਬਟ ਜੋ ਮੈਨੂੰ ਡਿਲੀਵਰ ਹੋਇਆ ਏ ਪ੍ਰੋਡਕਟ ਉਹਦੇ ਵਿੱਚ ਇੱਕ ਬਲੂ ਅਤੇ ਇੱਕ ਗਰੇਅ ਕਲਰ ਦੀ ਜੀਨ ਡਿਲੀਵਰ ਹੋਈ ਹੈ ਮੈਂ ਤੁਹਾਡੀ ਐਪ ਦੇ ਉੱਤੇ ਜਾ ਕੇ ਉਹਦਾ ਰਿਟਰਨ ਵੀ ਪਾਇਆ ਹੈ ਬਟ ਇੱਕ ਹਫਤਾ ਹੋ ਗਿਆ ਹੈ ਮੇਰੇ ਘਰੋਂ ਕੋਈ ਵੀ ਉਹ ਰਿਟਰਨ ਪਿੱਕ ਅਪ ਕਰਨ ਨਹੀਂ ਆ ਰਿਹਾ ਹੈ ਮੈਂ ਇਸਦੇ ਪੈਸੇ ਵੀ ਤੁਹਾਨੂੰ ਪਹਿਲਾਂ ਹੀ ਦੇ ਚੁੱਕੀ ਹਾਂ ਅਤੇ ਮੈਂ ਵੇਟ ਕਰ ਰਹੀ ਹਾਂ ਕਿ ਤੁਸੀਂ ਰਿਫੰਡ ਕਰੋਂਗੇ ਬਟ ਤੁਹਾਡੀ ਸਰਵਿਸ ਜੋ ਹੈ ਉਹ ਇੰਨੀ ਡੀਲੇਅ ਚੱਲ ਰਹੀ ਹੈ ਤੁਹਾਡੀ ਐਪ ਤੋਂ ਸਾਨੂੰ ਇਹ ਉਮੀਦ ਨਹੀਂ ਸੀ ਅਸੀਂ ਤੁਹਾਡੇ ਇਸ ਐਪ ਤੋਂ ਰੈਗੂਲਰਲੀ ਕੱਪੜੇ ਮੰਗਵਾਉਂਦੇ ਰਹਿੰਦੇ ਹਾਂ ਅਸੀਂ ਪ੍ਰੀਮੀਅਮ ਕਸਟਮਰ ਵੀ ਹਾਂ ਫਿਰ ਵੀ ਤੁਸੀਂ ਇਸ ਤਰ੍ਹਾਂ ਦੀਆਂ ਸੇਵਾਵਾਂ ਸਾਨੂੰ ਦੇ ਰਹੇ ਹੋ ਇਹ ਬੜੀ ਗਲਤ ਗੱਲ ਹੈ ਇਸ ਨਾਲ ਤੁਹਾਡੀ ਐਪ ਦੇ ਉੱਤੇ ਅਸ ਅਤੇ ਤੁਹਾਡੀ ਕੰਪਨੀ ਦੇ ਉੱਤੇ ਵੀ ਇੱਕ ਗਲਤ ਪ੍ਰਭਾਵ ਪਵੇਗਾ ਮੈਨੂੰ ਜਲਦ ਤੋਂ ਜਲਦ ਮੇਰੇ ਪੈਸੇ ਵਾਪਿਸ ਚਾਹੀਦੇ ਨੇ ਜਾਂ ਫਿਰ ਉਸ ਜੀਨ ਦੀ ਜਗ੍ਹਾਂ ਜਿਸ ਰੰਗ ਦੀ ਜੀਨ ਮੈਂ ਮੰਗਵਾਈ ਸੀ ਉਹ ਡਿਲਵਰ ਹੋਣੀ ਚਾਹੀਦੀ ਹੈ ਅਤੇ ਜੋ ਨੰਬਰ ਮੈਨੂੰ ਸ਼ੋਅ ਹੋ ਰਿਹਾ ਹੈ ਡਿਲਵਰੀ ਬੋਆਏ ਦਾ ਉਹ ਵੀ ਫੋਨ ਨਹੀਂ ਚੱਕ ਰਿਹਾ ਇੱਕ ਹਫਤਾ ਹੋ ਗਿਆ ਹੈ ਇਹ ਬੜੀ ਗਲ਼ਤ ਗੱਲ ਹੈ ਸਰ ਤੁਹਾਡੀ ਕੰਪਨੀ ਜੋ ਹੈ ਉਹ ਹਮੇਸ਼ਾ ਵਧੀਆ ਸੇਵਾਵਾਂ ਅਤੇ ਵਧੀਆ ਕ ਲਬ ਕ ਕੁਆਲਟੀ ਦੇ ਕੱਪੜੇ ਭੇਜਦੀ ਹੈ ਬਟ ਇਸ ਵਾਰ ਤੁਸੀਂ ਇਹ ਬਹੁਤ ਹੀ ਗਲ਼ਤ ਲਾਹਪ੍ਰਵਾਹੀ ਕੀਤੀ ਹੈ ਉਹ ਵੀ ਤਿਉਹਾਰਾਂ ਦੇ ਸਮੇਂ 'ਤੇ ਤਿਉਹਾਰਾਂ ਦੇ ਸਮੇਂ 'ਤੇ ਹੀ ਤਾਂ ਇਨਸਾਨ ਨੇ ਸ਼ੌਪਿੰਗ ਕਰਨੀ ਹੁੰਦੀ ਹੈ ਆਪਣੀ ਅਤੇ ਉਸ ਵਿੱਚ ਵੀ ਤੁਸੀਂ ਇਹੋ ਜਿਹੀਆਂ ਲਾਹਪ੍ਰਵਾਹੀਆਂ ਕਰਦੇ ਹੋ ਇਹ ਬੜੀ ਗਲਤ ਗੱਲ ਹੈ ਜਲਦ ਤੋਂ ਜਲਦ ਮੇਰੇ ਇਸ ਕੰਪਲੇਂਟ ਦਾ ਹੱਲ ਕੀਤਾ ਜਾਵੇ